ਵੈਸੇ ਤਾਂ ਮੈਨੂੰ ਚਿੱਤਰਕਾਰੀ ਕਰਨਾ ਬਹੁਤ ਪਸੰਦ ਹੈ ਅਤੇ ਜੇਕਰ ਚਿੱਤਰਕਾਰੀ ਕਰਨ ਦਾ ਸਮਾਂ ਦੀ ਗੱਲ ਕਰੀਏ ਤਾਂ ਭਿੰਨ ਭਿੰਨ ਚਿੱਤਰਕਾਰੀਆਂ ਲਈ ਭਿੰਨ ਭਿੰਨ ਤਰੀਕੇ ਦਾ ਸਮਾਂ ਲੱਗਦਾ ਹੈ ਜੇ ਮੈਂ ਕਹਾਂ ਕਿ ਮੈਂ ਇੱਕ ਸੀਨਰੀ ਬਣਾਉਣੀ ਹੈ ਜਿਸ ਵਿੱਚ ਮੈਨੂੰ ਕੁਦਰਤ ਨੂੰ ਦਰਸਾਉਣਾ ਹੈ ਕੁਛ ਮੈਨੂੰ ਘਰ ਬਣਾਉਣਾ ਹੈ ਤਾਂ ਉਸ ਦੇ ਹਿਸਾਬ ਨਾਲ ਮੈਨੂੰ ਘੱਟੋ ਘੱਟ ਇੱਕ ਤੋਂ ਦੋ ਘੰਟਾ ਲੱਗ ਸਕਦਾ ਹੈ ਕਿਉਂਕਿ ਉਸ ਵਿੱਚ ਪਹਿਲੇ ਮੈਨੂੰ ਉਸ ਚਿੱਤਰਕ ਚਿੱਤਰ ਨੂੰ ਪੂਰਾ ਪੈਨਸਲ ਨਾਲ ਡਰੋਅ ਕਰਨਾ ਪਵੇਗਾ ਫੇਰ ਉਸਨੂੰ ਇੱਕ ਸੀਰਾ ਦੇਣਾ ਪਵੇਗਾ ਉਸਤੋਂ ਬਾਅਦ ਬਹੁਤ ਅਲੱਗ ਅਲੱਗ ਤਰੀਕੇ ਦੇ ਪੇਂਟ ਕਲਰ ਜਿਹੜੇ ਹੁੰਦੇ ਹਨ ਉਹ ਮੈਨੂੰ ਉਸ ਵਿੱਚ ਇਸਤੇਮਾਲ ਕਰਕੇ ਉਸਨੂੰ ਇੱਕ ਦਿਸ਼ਾ ਉਸ ਨੂੰ ਇੱਕ ਬਹੁਤ ਅੱਛਾ ਰੰਗ ਬਰੰਗਾ ਦ੍ਰਿਸ਼ ਦੇਣਾ ਪਵੇਗਾ ਜੋ ਕਿ ਬਹੁਤ ਜ਼ਰੂਰੀ ਹੁੰਦਾ ਹੈ ਇੱਕ ਕਲਾ ਨੂੰ ਇੱਕ ਚਿੱਤਰ ਨੂੰ ਆਕਰਸ਼ਿਤ ਬਣਾਉਣ ਲਈ ਅਤੇ ਉਸ ਵਿੱਚ ਜਾਨ ਪਾਉਣ ਲਈ ਕਿਉਂਕਿ ਇਹ ਜੋ ਰੰਗ ਹੁੰਦੇ ਹਨ ਇਹ ਇੱਕ ਚਿੱਤਰ ਨੂੰ ਨਾ ਕਿ ਇੱਕ ਕਾਗਜ਼ 'ਤੇ ਬਲਕਿ ਕਿਸੇ ਦੇ ਭਾਵਨਾਵਾਂ ਕਿਸੇ ਦੀ ਅੱਖਾਂ 'ਤੇ ਵੀ ਇਹ ਇੱਕ ਹਕੀਕਤ ਦੇ ਵਾਂਗੂ ਚੜਾ ਦਿੰਦੇ ਹਨ ਇਸ ਕਰਕੇ ਇਹਨਾਂ ਨੂੰ ਸਮਾਂ ਦੇਣਾ ਅਤੇ ਉਸ ਨੂੰ ਅੱਛੇ ਤਰੀਕੇ ਨਾਲ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ